ਖੇਤੀਬਾੜੀ ਦੇ ਵਿੱਚ ਬਹੁਤ ਸਾਰੇ ਸਾਧਨ ਵਰਤੇ ਜਾਂਦੇ ਨੇ ਜਿਵੇਂ ਆਧੁਨਿਕ ਖੇਤੀ ਦੇ ਵਿੱਚ ਤਾਂ ਬਹੁਤ ਸਾਰੀਆਂ ਖੋਜਾਂ ਹੋਈਆਂ ਨੇ ਜਿਸਦੇ ਵਿੱਚ ਟਰੈਕਟਰ ਟਿਊਵੈਲ ਇਹ ਚੀਜ਼ਾਂ ਹੁਣ ਡਿਵੈਲਪ ਹੋਈਆਂ ਨੇ ਇਹਨਾਂ ਦੇ ਵੱਖ ਵੱਖ ਉਦੇਸ਼ ਨੇ ਜਿਵੇਂ ਟਿਊਵੈਲ ਸਿੰਚਾਈ ਲਈ ਵਰਤਿਆ ਜਾਂਦਾ ਟਰੈਕਟਰ ਵਾਹੀ ਕਰਨ ਲਈ ਟਰੈਕਟਰ ਦੇ ਨਾਲ ਹੋਰ ਵੀ ਕਾਫੀ ਸੰਦ ਜਿਹੜੇ ਜੁੜੇ ਹੋਏ ਨੇ ਜਿਵੇਂ ਹੋ ਗਿਆ ਕੁਰਾਹਾ ਸੁਹਾਗਾ ਤਵੀਆਂ ਰੋਟਾਵੇਟਰ ਡਰਿੱਲ ਡਰਿੱਲ ਜਿਵੇਂ ਬਿਜਾਈ ਲਈ ਵਰਤੀ ਜਾਂਦੀ ਹੈ ਤਵੀਆਂ ਵਾਹੀ ਲਈ ਧਰਤੀ ਨੂੰ ਜਿਹੜਾ ਨਰਮ ਕਰਨ ਲਈ ਵਰਤੀ ਜਾਂਦੀ ਹੈ ਅਤੇ ਸੁਹਾਗਾ ਜਿਹੜਾ ਅਤੇ ਕੁਰਾਹਾ ਉਹ ਧਰਤੀ ਦਾ ਲੈਵਲ ਸਹੀ ਕਰਨ ਲਈ ਵਰਤਿਆ ਜਾਂਦਾ ਇਹ ਸਾਰੀਆਂ ਚੀਜ਼ਾਂ ਖੇਤੀਬਾੜੀ ਦੇ ਵਿੱਚ ਅੱਜ ਕੱਲ੍ਹ ਵਰਤੀਆਂ ਜਾਂਦੀਆਂ ਨੇ ਅਤੇ ਖੇਤੀ ਬਹੁਤ ਸੌਖੀ ਹੋ ਗਈ ਹੈ ਸਾਧਨਾਂ ਦੇ ਨਾਲ ਬਹੁਤ ਸਾਰੇ ਨਵੇਂ ਨਵੇਂ ਸਾਧਨ ਆ ਰਹੇ ਨੇ ਜਿਵੇਂ ਹੈਪੀ ਸੀਡਰ ਆ ਰਿਹਾ ਇਹਦੇ ਨਾਲ ਕੀ ਹੈ ਜੇ ਤੁਸੀਂ ਨਾੜਾਂ ਨੂੰ ਅੱਗ ਨਹੀਂ ਲਾਉਣੀ ਤਾਂ ਖੇਤੀ ਦੇ ਤੁਸੀਂ ਉਹ ਨਾੜਾਂ ਨੂੰ ਉੱਥੇ ਹੀ ਵਾਹ ਕੇ ਉੱਥੇ ਹੀ ਬਿਜਾਈ ਕਰ ਸਕਦੇ ਹੋ ਪਰਾਲੀ ਨਾ ਉਹਨੂੰ ਅੱਗ ਨਾ ਲਾਉਣ ਲਈ ਇਹ ਇੱਕ ਵਧੀਆ ਸਾਧਨ ਜਿਹੜਾ ਡਿਵੈਲਪ ਕੀਤਾ ਗਿਆ ਬਹੁਤ ਸਾਰੇ ਨਵੇਂ ਸਾਧਨ ਆ ਰਹੇ ਨੇ ਜੋ ਅਜੇ ਇੰਡੀਆ ਦੇ ਵਿੱਚ ਨਹੀਂ ਵੀ ਆਏ ਪਰ ਖੇਤੀਬਾੜੀ ਬਹੁਤ ਸੌਖੀ ਹੋ ਗਈ ਆ ਸਾਧਨਾਂ ਦੇ ਨਾਲ ਕਿਸਾਨ ਬਹੁਤ ਉੱਚਿਤ ਤਰੀਕੇ ਨਾਲ ਇਹਨਾਂ ਦੀ ਵਰਤੋਂ ਕਰ ਰਹੇ ਨੇ ਜਿਹਦੇ ਨਾਲ ਉਹਨਾਂ ਨੂੰ ਟਾਈਮ ਦੀ ਵੀ ਬੱਚਤ ਹੋ ਜਾਂਦੀ ਹੈ ਅਤੇ ਉਹਨਾਂ ਦਾ ਝਾੜ ਵੀ ਵਧੀਆ ਨਿਕਲਦਾ ਅਤੇ ਸੌਖਾ ਕਰ ਦਿੱਤਾ ਮਤਲਬ ਆਪਾਂ ਓਵਰਔਲ ਕਹਿ ਸਕਦੇ ਹਾਂ ਇਸ ਚੀਜ਼ ਨੇ ਵਧੀਆ ਚੀਜ਼ ਹੈ ਇਹ ਸ ਖੇਤੀਬਾੜੀ ਦੇ ਜਿਹੜੇ ਸਾਧਨ ਨੇ ਉਹ ਕਿਸਾਨ ਅਪਣਾ ਰਹੇ ਨੇ ਆਪਣੀ ਲਾਈਫ ਦੇ ਵਿੱਚ